ਹੈਲੋ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਹਿਬ ਓਕੇ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਜ਼ਰੂਰ ਸਰ ਇਹ ਦੀ ਸਰ ਹੈ ਜੀ ਤਕਰੀਬਨ ਬਾਈ ਹਜ਼ਾਰ ਜੀ ਹਾਂਜੀ ਹਾਂਜੀ ਪੂਰਾ ਕਸਬਾ ਜੀ ਇਹ ਹਾਂਜੀ ਹਾਂਜੀ ਹਾਂਜੀ ਜ਼ਰੂਰ ਸਰ ਜ਼ਰੂਰ ਇਥੇ ਸਰ ਇੱਕ ਦੁਰਗਾ ਮਾਤਾ ਜੀ ਦਾ ਮੰਦਰ ਹੈ ਜੀ ਛੇ ਮਹੀਨੇ ਬਾਅਦ ਨਰਾਤਿਆਂ ਦਾ ਮੇਲਾ ਮਨਾਇਆ ਜਾਂਦਾ ਇੱਕ ਤਾਂ ਉੱਥੇ ਪੂਰਾ ਧੂਮ ਧਾਮ ਨਾਲ ਅਤੇ ਮਤਲਬ ਲੋਕ ਹੈ ਜੋ ਨਰਾਤਿਆਂ ਦੇ ਵਿੱਚ ਪਹਿਲਾਂ ਮੱਥਾ ਟੇਕਣ ਜਾਂਦੇ ਹੈ ਜੀ ਛੇ ਦਿਨ ਪੂਰੇ ਸਤਵੇਂ ਦਿਨ ਪੂਰਾ ਮੇਲਾ ਭਰਦਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਉੱਥੇ ਅਤੇ ਦੂਸਰਾ ਜਨਮ ਅਸ਼ਟਮੀ ਹਾਂਜੀ ਹਾਂਜੀ ਬਿਲਕੁਲ ਜੀ ਬਾਹਰਲੇ ਇਲਾਕਿਆਂ ਤੋਂ ਬਹੁਤ ਆਉਂਦੇ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਹੈ ਜੀ ਮੱਥਾ ਟੇਕਣ ਆਉਂਦੇ ਆ ਬਾਕੀ ਇੱਕ ਦੂਜੇ ਨੂੰ ਦੱਸਦੇ ਹੈ ਕਾਫੀ ਭਾਰੀ ਇਕੱਠ ਹੁੰਦਾ ਜੀ ਹਾਂਜੀ ਬਾਕੀ ਜਨਮ ਅਸ਼ਟਮੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਜੀ ਇੱਥੇ ਜੋ ਪਿੰਡ ਦੇ ਵਿੱਚ ਕਾਫੀ ਮੰਦਰ ਨੇ ਸਾਰੇ ਮੰਦਰਾਂ 'ਚ ਵੀ ਵੈਸੇ ਤਾਂ ਮਨਾਈ ਜਾਂਦੀ ਹੈ ਲੇਕਿਨ ਦੋ ਤਿੰਨ ਮੰਦਰ ਜਿਹੜੇ ਆਪਣੇ ਮੇਨ ਨੇ ਜੀ ਪ੍ਰਸਿੱਧ ਪੁਰਾਤਨ ਮੰਦਰ ਨੇ ਉਹਨਾਂ ਦੇ ਵਿੱਚ ਜਿਵੇਂ ਸੱਭੇ ਰਾਜ਼ੀ ਹੈ ਉਸ ਦੇ ਵਿੱਚ ਬੜੀ ਜਨਮ ਅਸ਼ਟਮੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਕਾਫੀ ਦਿਨ ਪਹਿਲਾਂ ਤੁਸੀਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਝਾਕੀਆਂ ਨਿਕਲਦੀਆਂ ਨੇ ਹਾਂਜੀ ਬੜੀ ਤੋਂ ਉੱਥੇ ਵੀ ਲੋਕ ਬੜੀ ਸੰਗਤ ਜਿਹੜੀ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀ ਹੈਗੀ ਕਾਫੀ ਪੁਰਾਤਨ ਮੰਦਰ ਆ ਜੀ ਉਹ ਹਾਂਜੀ ਇਤਿਹਾਸਿਕ ਮੇਲਾ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਜੀ ਹਾਂ ਜਨ ਜੁਲਾ ਜਨਵਰੀ ਦੇ ਵਿੱਚ ਤਕਰੀਬਨ ਦਸ ਗਿਆਰਾਂ ਬਾਰਾਂ ਜਨਵਰੀ ਨੂੰ ਜਿਹਦੇ ਵਿੱਚ ਵਿਚਾਲੜੇ ਦਿਨ ਜਿਹੜਾ ਗਿਆਰਾਂ ਤਰੀਕ ਨੂੰ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਜੀ ਭਾਰੀ ਉਹਦੇ ਵਿੱਚ ਬਹੁਤ ਇਕੱਠ ਹੁੰਦਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਹਾਜ਼ਰੀ ਲਵਾਉਂਦੀਆਂ ਨੇ ਜੀ ਤੇਰ੍ਹਾਂ ਤਰੀਕ ਨੂੰ ਫਿਰ ਬਾਰ੍ਹਾਂ ਤਰੀਕ ਨੂੰ ਭੋਗ ਪਾਏ ਜਾਂਦੇ ਨੇ ਹਾਂਜੀ ਹਾਂਜੀੀ

ਹਾਂਜੀ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਜੀ ਬਿਲਕੁਲ ਬਿਲਕੁਲ ਬਾਕੀ ਪਿੰਡ ਦੇ ਵਿੱਚ ਬਹੁਤ ਏਕਾ ਜੀ ਸਾਰੇ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਨੇ ਧੰਨਵਾਦ ਸਰ ਸ਼ੁਕਰੀਆ ਜੀ ਓਕੇ ਜੀ